ਪੰਜਾਬ ਵਿੱਚ ਪੀ ਜੀ ਆਈ ਆਈ ਵੀ ਫੋਰਟਿਸ ਡੀ ਐਮ ਸੀ ਮਨੀਪਾਲ ਆਦਿ ਵਰਗੇ ਕਈ ਹਸਪਤਾਲ ਹਨ ਇਹ ਸਾਰੇ ਮਲਟੀ ਸਪੈਸ਼ਲਿਟੀ ਹਸਪਤਾਲ ਹਨ ਜਿੰਨ੍ਹਾਂ ਵਿੱਚ ਕਿ ਮਰੀਜ਼ਾਂ ਨੂੰ ਹਰ ਇੱਕ ਰੋਗ ਨਾਲ ਸੰਬੰਧਿਤ ਮਾਹਿਰ ਡਾਕਟਰ ਮਿਲ ਜਾਂਦੇ ਹਨ ਪੀ ਜੀ ਆਈ ਚੰਡੀਗੜ੍ਹ ਦੀ ਪ੍ਰਸਿੱਧ ਹਸਪਤਾਲ ਹੈ ਜਿੱਥੇ ਮਰੀਜ਼ਾਂ ਦੀ ਕਠਿਨ ਤੋਂ ਕਠਿਨ ਬਿਮਾਰੀ ਦਾ ਇਲਾਜ ਸੰਭਵ ਹੈ ਇਸ ਨੇ ਦੇਸ਼ ਦੇ ਵੱਡੇ ਵੱਡੇ ਹਸਪਤਾਲਾਂ ਨੂੰ ਪਛਾੜਿਆ ਹੈ ਇਸ ਦਾ ਭਾਰਤ ਵਿੱਚ ਦੂਜਾ ਸਥਾਨ ਹੈ ਪਹਿਲੇ ਸਥਾਨ 'ਤੇ ਦਿੱਲੀ ਦਾ ਏਮਜ ਹਸਪਤਾਲ ਹੈ ਆਈ ਵੀ ਅੰਮ੍ਰਿਤਸਰ ਸਾਹਿਬ ਦੇ ਕੇਂਦਰ ਵਿੱਚ ਸਥਿਤ ਆਧੁਨਿਕ ਸੁਵਿਧਾਵਾਂ ਵਾਲਾ ਹਸਪਤਾਲ ਹੈ ਜਿੱਥੇ ਮਰੀਜ਼ਾਂ ਦੀ ਦੇਖਭਾਲ ਦਿਆਲੂ ਭਾਵ ਨਾਲ ਕੀਤੀ ਜਾਂਦੀ ਹੈ ਫੋਰਟੀਸ ਹਸਪਤਾਲ ਵੀ ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਸਥਿੱਤ ਹੈ ਇਹ ਵੀ ਮਲਟੀ ਸਪੈਸਲਿਟੀ ਹਸਪਤਾਲ ਹਨ ਜਿੱਥੇ ਹਰ ਇੱਕ ਰੋਗਾਂ ਦੇ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਵਧੀਆ ਅਤੇ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ ਡੀ ਐਮ ਸੀ ਸੀ ਐਮ ਸੀ ਲੁਧਿਆਣੇ ਜ਼ਿਲ੍ਹੇ ਦੇ ਹਸਪਤਾਲ ਹਨ ਜਿੱਥੇ ਕਿ ਦੂਰੋਂ ਦੂਰੋਂ ਮਰੀਜ਼ ਇਲਾਜ ਕਰਵਾਉਣ ਆਉਂਦੇ ਹਨ